ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੂੰ ਸਥਾਨਿਕ ਕਲਾ ਅਤੇ ਸ਼ਿਲਪਕਾਰੀ ਬਹੁਤ ਵਿਲੱਖਣ ਕਰਦੀ ਹੈ ਸਾਡੇ ਜ਼ਿਲ੍ਹੇ ਵਿੱਚ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸਾਡੇ ਜ਼ਿਲ੍ਹੇ ਦੇ ਨੌਜਵਾਨ ਚਿੱਟਾ ਕੁੜਤਾ ਪਜਾਮਾ ਤਿੱਲੇਦਾਰ ਜੁੱਤੀ ਅਤੇ ਪੌਚਵੀ ਪੱਗ ਦੇ ਨਾਲ ਕੈਂਠਾ ਪਾਉਂਦੇ ਹਨ ਜਦ ਸ ਸਾਡੇ ਜ਼ਿਲ੍ਹੇ ਦੀਆਂ ਔਰਤਾਂ ਬੀਬੀਆਂ ਪਟਿਆਲਾ ਸ਼ਾਹੀ ਸੂਟ ਸੱਗੀ ਫੁੱਲ ਅਤੇ ਗੁੱਤ 'ਚ ਪਰਾਂਦਾ ਦੇ ਨ ਨਾਲ ਜੁੱਤੀ ਪਾਉਂਦੀਆਂ ਹਨ ਸਾਡੇ ਜਦੋਂ ਵੀ ਅਸੀਂ ਕਿਸੇ ਦੂਸਰੇ ਜ਼ਿਲ੍ਹੇ ਵਿੱਚ ਜਾਂਦੇ ਹਾਂ ਤਾਂ ਉਹ ਸਾਨੂੰ ਦੂਰੋਂ ਹੀ ਪਛਾਣ ਲੈਂਦੇ ਹਨ ਕਿਉਂਕਿ ਸਾਡਾ ਪਹਿਰਾਵਾ ਦੂਸਰੇ ਜ਼ਿਲ੍ਹੇ ਨਾਲੋਂ ਵੱਖ ਹੈ